ਹਾਂਜੀ ਮੈਂ ਇਹੋ ਜੀ ਕਿਤਾਬ ਪੜ੍ਹੀ ਹੈ ਜਿਹੜੀ ਪੜ੍ਹਦੇ ਸਾਰ ਹੀ ਨਾ ਪਹਿਲੇ ਪੇਜ ਤੋਂ ਹੀ ਮਤਲਬ ਨਾ ਦਰਦ ਝਲਕਦਾ ਅਤੇ ਅਗਰ ਚਾਰ ਪੰਜ ਪੰਨੇ ਵਰਤਨ ਤੋਂ ਬਾਅਦ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਉਹ ਅਸੀਂ ਉਹਦੇ ਕਰੈਕਟਰ ਵੀ ਸਾਡਾ ਆਪ ਹੀ ਅਸੀਂ ਕਰੈਕਟਰ ਬਣ ਜਾਂਦੇ ਹਾਂ ਉਹ 'ਚ ਪੜ੍ਹਦੇ ਪੜ੍ਹਦੇ ਇਹ ਹੈ ਮੁਨਸ਼ੀ ਪ੍ਰੇਮ ਚੰਦ ਦੀ ਗੋਦਾਨ ਇਹ 'ਚ ਬਹੁਤ ਜ਼ਿਆਦਾ ਭਾਵੁਕਤਾ ਜਿਹੜੀ ਸਮਾਜ ਦੀ ਸੱਚਾਈ ਕਿਸ ਤਰ੍ਹਾਂ ਸਮਾਜ ਦੇ ਵਿੱਚ ਬੰਦਿਆਂ ਦੇ ਦਰਦ ਔਰਤਾਂ ਦਾ ਦਰਦ ਪੂਰਾ ਬਹੁਤ ਸੋਹਣੇ ਤਰੀਕੇ ਨਾਲ ਇੱਕ ਇੱਕ ਜਿਹੜੀ ਲਾਈਨ ਹੈ ਨਾ ਅੱਖਰ ਉਹ ਉੱਭਰ ਉੱਭਰ ਕੇ ਜਿਹੜਾ ਉਹ ਪੇਸ਼ ਹੁੰਦਾ ਹੈਗਾ ਵੀ ਇੱਕ ਇੱਕ ਅੱਖਰ ਦੱਸਦਾ ਹੈਗਾ ਵੀ ਕੀ ਕੀ ਪ੍ਰੋਬਲਮ ਸਮਾਜ ਦੇ ਵਿੱਚ ਹੈ ਇਹ ਨਾਵਲ ਪੜ੍ਹਨ ਲੱਗੇ ਨਾ ਜਦੋਂ ਸਟਾਰਟ ਕੀਤਾ ਤਾਂ ਬੜਾ ਮਹਿਸੂਸ ਜਿਹਾ ਹੋਇਆ ਵੀ ਇੰਨਾਂ ਵੱਡਾ ਨਾਵਲ ਕਿੱਥੋਂ ਪੜ੍ਹਿਆ ਜਾਣਾ ਲੇਕਿਨ ਜਦੋਂ ਸਟਾਰਟ ਕੀਤਾ ਤਾਂ ਹਾਲਾਂਕਿ ਟਾਈਮ ਇੰਨਾਂ ਘੱਟ ਸੀਗਾ ਪਰ ਫਿਰ ਵੀ ਐਂ ਲੱਗਦਾ ਸੀਗਾ ਵੀ ਇਹ ਖਤਮ ਕਰਕੇ ਹੀ ਬੰਦ ਕਰਕੇ ਹੀ ਇਹਨੂੰ ਕਲੋਜ ਕਰਾਂ ਕ ਪੂਰਾ ਕਲੋਜ ਕਰਾਂ ਇਸਨੂੰ ਤਾਂ ਦਿਲ ਬਹੁਤ ਕਰਦਾ ਸੀ ਪੜ੍ਹਨ ਦਾ ਅਤੇ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਚਾਹੇ ਦੋ ਤਿੰਨ ਸਟੈਪ 'ਚ ਪੜ੍ਹਿਆ ਪਰ ਲੇਕਿਨ ਅੱਜ ਵੀ ਉਹ ਪੜ੍ਹੇ ਨੂੰ ਦਸ ਸਾਲ ਹੋ ਗਏ ਬੇਸ਼ੱਕ ਅੱਜ ਵੀ ਕਹਾਣੀ ਐਨ ਚੇਤੇ 'ਚ ਵਸੀ ਹੋਈ ਹੈ ਓਹ ਰੂਹ ਉੱਭਰ ਉੱਭਰ ਕੇ ਆਉਂਦੀ ਹੈ ਵੀ ਕਿਸ ਤਰ੍ਹਾਂ ਉਹ ਜਿਹੜੇ ਕਰੈਕਟਰ ਸੀ ਉਹਦੇ ਅੰਦਰ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰ ਰਹੇ ਹੈ ਤਾਂ ਐਂ ਲੱਗਦਾ ਵੀ ਉਹ ਕਰੈਕਟਰਾਂ ਦੇ ਵਿੱਚ ਵੀ ਮੇਰਾ ਆਪਣਾ ਪੜ੍ਹਦੇ ਹੋਏ ਬੰਦੇ ਨੂੰ ਮਹਿਸੂਸ ਹੁੰਦਾ ਕਿ ਮੈਂ ਵੀ ਇੱਕ ਕਰੈਕਟਰ ਹਾਂ ਵੀ ਮੇਰੇ ਸਾਹਮਣੇ ਹੂੂ ਬ ਹੂ ਚੀਜ਼ ਚੱਲ ਰਹੀ ਹੈ